ਮੈਨੂੰ ਜ਼ਿਆਦਾਤਰ ਪੰਜਾਬੀ ਫਿਲਮਾਂ ਪਸੰਦ ਹਨ ਪੰਜਾਬੀ ਫਿਲਮਾਂ ਦੇ ਵਿੱਚ ਲਹੋਰੀਏ ਫਿਲਮ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਜੋ ਕਿ ਅਮਰਿੰਦਰ ਗਿੱਲ ਦੀ ਹੈ ਅਤੇ ਇਸ ਫਿਲਮ ਦੀ ਜਿਹੜੀ ਕਹਾਣੀ ਆ ਉਹ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਜਿਹੜੀ ਪਿਆਰ ਮੁਹੱਬਤ ਦੀ ਸਟੋਰੀ ਆ ਇੱਕ ਮੁੰਡਾ ਅਤੇ ਕੁੜੀ ਦਾ ਆਪਸ ਵਿੱਚ ਪ੍ਰੇਮ ਪਿਆਰ ਹੋ ਜਾਂਦਾ ਹੈ ਅਤੇ ਜਿਹੜਾ ਅਮਰਿੰਦਰ ਗਿੱਲ ਹੈ ਉਹ ਇੰਡੀਆ ਪੰਜਾਬ ਤੋਂ ਹੁੰਦਾ ਹੈ ਅਤੇ ਜਿਹੜੀ ਕੁੜੀ ਹੈ ਉਹ ਪਾਕਿਸਤਾਨ ਪੰਜਾਬ ਤੋਂ ਹੁੰਦੀ ਹੈ ਅਤੇ ਦੋਹਾਂ ਨੂੰ ਖੇਤ ਹੁੰਦੇ ਦੋਨਾਂ ਦੇ ਬਾਰਡਰ 'ਤੇ ਦੋਹਾਂ ਦਾ ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਪਿਆਰ ਹੁੰਦੇ ਹੁੰਦੇ ਜਿਹੜਾ ਅਮਰਿੰਦਰ ਗਿੱਲ ਆ ਉਹ ਆਪਣੇ ਪਾਕਿਸਤਾਨ ਪਹੁੰਚ ਜਾਂਦਾ ਪਾਕਿਸਤਾਨ ਪਹੁੰਚ ਜਾਂਦਾ ਕੁੜੀ ਦੇ ਮਗਰ ਉਸ ਨਾਲ ਵਿਆਹ ਕਰਵਾਉਣ ਲਈ ਅਤੇ ਉੱਥੇ ਜਾ ਕੇ ਉਹ ਆਪਣੀ ਜਿਹੜੀ ਕਹਾਣੀ ਆ ਉਹਨਾਂ ਨੂੰ ਅੱਗੇ ਵਧਾਉਂਦੇ ਆ ਲਵ ਪਿਆਰ ਨੂੰ ਅਤੇ ਵਧੀਆ ਉੱਥੇ ਆਪਣੇ ਫਿਰ ਉਹ ਮੰਨ ਜਾਂਦੇ ਆ ਕੁੜੀ ਵਾਲੇ ਵੀ ਫਿਰ ਦੋਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਅਤੇ ਫਿਰ ਉਹ ਅਮਰਿੰਦਰ ਗਿੱਲ ਉਹਨੂੰ ਵਾਪਸ ਲੈ ਆਉਂਦਾ ਵਿਆਹ ਕੇ ਪਰ ਵਧੀਆ ਚਲੋ ਇੰਜੋਏ ਕਰਦੇ ਆ ਉਹ ਆਪਣਾ ਇਸ ਕਰਕੇ ਮੈਨੂੰ ਇਹ ਫਿਲਮ ਬਹੁਤ ਵਧੀਆ ਲੱਗੀ